ਪਹਿਲੇ ਸਮੇਂ ਵਿੱਚ ਲੋਕਾਂ ਦਾ ਮਨੋਰੰਜਨ ਦਾ ਸਾਧਨ ਫਿਲਮਾਂ ਹੁੰਦੀਆਂ ਸੀ ਲੋਕ ਫਿਲਮਾਂ ਦੇਖਣ ਲਈ ਉਹਨਾਂ ਨੂੰ ਇੰਨਾ ਜ਼ਿਆਦਾ ਕਰੇਜ਼ ਹੁੰਦਾ ਸੀ ਕਿ ਲੋਕ ਫਿਲਮਾਂ ਦੇਖਣ ਲਈ ਕਿੰਨੇ ਕਿੰਨੇ ਦਿਨ ਤਿਆਰੀ ਕਰਦੇ ਰਹਿੰਦੇ ਸੀ ਆ ਕੇ ਕਿੰਨੇ ਕਿੰਨੇ ਦਿਨ ਫਿਲਮਾਂ ਦੀਆਂ ਗੱਲਾਂ ਹੀ ਕਰਦੇ ਰਹਿਣਾ ਇਸ ਤੋਂ ਇਲਾਵਾ ਕਿਤਾਬਾਂ ਪੜ੍ਹਨ ਦਾ ਲੋਕਾਂ ਨੂੰ ਬੜਾ ਸ਼ੌਕ ਹੁੰਦਾ ਸੀ ਲੋਕਾਂ ਨੇ ਕਿਤਾਬਾਂ ਪੜ੍ਹਨੀਆਂ ਕਿੱਸੇ ਪੜ੍ਹਨੇ ਨਾਵਲ ਪੜ੍ਹਨੇ ਜੇ ਵੱਡਿਆਂ ਨੇ ਰੋਕਣਾ ਤਾਂ ਉਹਨਾਂ ਨੇ ਲੁਕ ਲੁਕ ਕੇ ਨਾਵਲ ਪੜ੍ਹਨੇ ਆਪਣੇ ਬਿਸਤਰਿਆਂ ਦੇ ਵਿੱਚ ਲੁਕੋ ਕੇ ਰੱਖਣੇ ਨਾਵਲ ਕਿਤਾਬਾਂ ਪੜ੍ਹਨੀਆਂ ਅਤੇ ਇਸ ਤੋਂ ਇਲਾਵਾ ਹੋਰ ਵੀ ਏ ਇਹੋ ਜਿਹੇ ਉਹਨਾਂ ਦੇ ਮਨੋਰੰਜਨ ਦੇ ਸਾਧਨ ਹੁੰਦੇ ਸੀ ਹੌਲੀ ਹੌਲੀ ਜਿਵੇਂ ਜਿਵੇਂ ਉਦਯੋਗ ਦਾ ਵਿਕਾਸ ਹੋਇਆ ਮਨੋਰੰਜਨ ਦੇ ਉਦਯੋਗ ਦਾ ਅਤੇ ਲੋਕ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਟੀ ਵੀ ਆ ਗਏ ਟੀ ਵੀ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਉਣੇ ਸ਼ੁਰੂ ਹੋ ਗਏ ਲੋਕਾਂ ਨੂੰ ਸੀਰੀਅਲ ਦਾ ਬੜਾ ਕਰੇਜ਼ ਹੋ ਗਿਆ ਲੋਕਾਂ ਨੇ ਬੜਾ ਕੁਛ ਟੀ ਵੀ 'ਤੇ ਦੇਖਣਾ ਸ਼ੁਰੂ ਕਰ ਦਿੱਤਾ ਟੀ ਵੀ ਜਿਵੇਂ ਸ਼ਾਮ ਨੂੰ ਸ਼ੁਰੂ ਹੋਣਾ ਅੰਟੀਨੇ ਲੱਗੇ ਹੁੰਦੇ ਸੀ ਲੋਕਾਂ ਨੇ ਜੇ ਫੋਟੋ ਨਹੀਂ ਆ ਰਹੀ ਤਾਂ ਲੋਕਾਂ ਨੇ ਅੰਟੀਨੇ ਘੁੰਮਾ ਘੁੰਮਾ ਕੇ ਉਹਨੂੰ ਲੈਣਾ ਅਤੇ ਪਾਗਲ ਹੀ ਹੋਏ ਰਹਿੰਦੇ ਸੀ ਟੀ ਵੀ ਪਿੱਛੇ ਹੌਲੀ ਹੌਲੀ ਕੇਬਲ ਆ ਗਈ ਫੇਰ ਕਿੰਨਾ ਸਾਰਾ ਦਿਨ ਚੌਵੀ ਘੰਟੇ ਪ੍ਰੋਗਰਾਮ ਤੁਸੀਂ ਲਉ ਅਤੇ ਚੌਵੀ ਘੰਟੇ ਲੋਕਾਂ ਨੇ ਮਤਲਬ ਪ੍ਰੋਗਰਾਮ ਜਦੋਂ ਮਰਜ਼ੀ ਜਿਹੜਾ ਮਰਜ਼ੀ ਪ੍ਰੋਗਰਾਮ ਦੇਖਣ ਲੱਗ ਪਏ ਹੌਲੀ ਹੌਲੀ ਕੀ ਹੋਇਆ ਕਿ ਫੇਰ ਉਸ ਤੋਂ ਬਾਅਦ ਮੋਬਾਈਲ ਆ ਗਏ ਲੋਕਾਂ ਦਾ ਮਨੋਰੰਜਨ ਦਾ ਸਾਧਨ ਸਭ ਤੋਂ ਵੱਡਾ ਜਿਹੜਾ ਸੀ ਫਿਰ ਮੋਬਾਈਲ ਹੋ ਗਿਆ ਟੀ ਵੀ ਤੋਂ ਥੋੜ੍ਹਾ ਜਿਹਾ ਲੋਕਾਂ ਦਾ ਧਿਆਨ ਘੱਟ ਗਿਆ ਹੁਣ ਤੁਸੀਂ ਦੇਖੋ ਕਿ ਮੋਬਾਈਲ ਦੇ ਵਿੱਚ ਮਨੋਰੰਜਨ ਦਾ ਸਭ ਕੁਛ ਹੈ ਤੁਸੀਂ ਗਾਣੇ ਸੁਣ ਸਕਦੇ ਹੋ ਤੁਸੀਂ ਗੇਮਾਂ ਖੇਡ ਸਕਦੇ ਹੋ ਤੁਸੀਂ ਰੀਲਸ ਦੇਖਦੇ ਹੋ ਤੁਸੀਂ ਕਿੰਨੇ ਹੀ ਜੋ ਮਰਜ਼ੀ ਜੋ ਮਰਜ਼ੀ ਤੁਸੀਂ ਉਹਦੇ 'ਚ ਦੇਖ ਸਕਦੇ ਹੋ ਅਤੇ ਆਪਣਾ ਮਨੋਰੰ ਭਰਪੂਰ ਮਨੋਰੰਜਨ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਦਾ ਮਨੋਰੰਜਨ ਦਾ ਸਾਧਨ ਬਣ ਗਿਆ ਹੈ ਜਿਸ ਤਰ੍ਹਾਂ ਹੁਣ ਵੈੱਬ ਸੀਰੀਜ਼ ਆ ਗਈਆਂ ਨੇ ਓ ਟੀ ਟੀ ਪਲੈਟਫੋਰਮ ਆ ਗਏ ਨੇ ਕ੍ਰਿਕਟ ਵਰਗੀ ਖੇਡ ਦਾ ਲੋਕਾਂ ਨੂੰ ਬੜਾ ਜ਼ਿਆਦਾ ਕਰੇਜ਼ ਹੋ ਗਿਆ ਹੈ ਇਹ ਸਾਰੇ ਹੀ ਸਾਡੇ ਦੇਸ਼ ਦੇ ਵਿੱਚ ਮਨੋਰੰਜਨ ਦੇ ਸਾਧਨ ਨੇ ਅਤੇ ਜੋ ਜਿਸ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਕਿ ਲੋਕ ਕੀ ਖਾਣਾ ਪੀਣਾ ਪਸੰਦ ਕਰਦੇ ਨੇ ਅਸੀਂ ਅੰਮ੍ਰਿਤਸਰ 'ਚ ਜਿਸ ਤਰ੍ਹਾਂ ਰਹਿੰਦੇ ਹਾਂ ਅਤੇ ਅੰਮ੍ਰਿਤਸਰ ਦੇ ਵਿੱਚ ਖਾਣ ਪੀਣ ਦਾ ਬਹੁਤ ਸਮਾਨ ਮਿਲਦਾ ਹੈ ਜਿਹਦੇ ਵਿੱਚੋਂ ਕੁਲਚਾ ਜਿਹੜਾ ਹੈ ਅੰਮ੍ਰਿਤਸਰੀ ਕੁਲਚਾ ਉਹ ਲੋਕ ਬਹੁਤ ਪਸੰਦ ਕਰਦੇ ਨੇ ਜੇ ਕੋਈ ਬਾਹਰੋਂ ਵੀ ਆਵੇ ਲੋਕ ਕਹਿੰਦੇ ਜੀ ਅਸੀਂ ਤਾਂ ਅੰਮ੍ਰਿਤਸਰੀ ਕੁਲਚਾ ਹੀ ਖਾਣਾ ਹੈ ਬਹੁਤ ਸਾਰਾ ਸਮਾਨ ਖਾਣ ਪੀਣ ਨੂੰ ਮੈਨੂੰ ਮਿਲਦਾ ਹੈ ਪਰ ਕੁਲਚੇ ਵਰਗੀ ਗੱਲ ਕਿਤੇ ਨਹੀਂ ਮਿਲਦੀ ਹਰ ਸ਼ਹਿਰ ਦੇ ਵਿੱਚ ਕੁਲਚਾ ਹੈ ਪਰ ਅੰਮ੍ਰਿਤਸਰ ਵਰਗਾ ਕੁਲਚਾ ਕਿਤੇ ਨਹੀਂ ਮਿਲਦਾ ਖਾਣ ਪੀਣ ਦੇ ਇਹਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਦਾ ਬਹੁਤ ਜ਼ਿਆਦਾ ਨੰਬਰ ਅੱਗੇ ਹੈ ਬਹੁਤ ਸਮਾਨ ਇੱਥੇ ਖਾਣ ਪੀਣ ਨੂੰ ਮਿਲਦਾ ਹੈ ਇਸ ਤੋਂ ਇਲਾਵਾ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਦੂਸਰੀਆਂ ਚੀਜ਼ਾਂ ਵੱਲ ਵੀ ਲੋਕਾਂ ਦਾ ਰੁਝਾਨ ਹੋ ਗਿਆ ਹੈ ਜਿਸ ਤਰ੍ਹਾਂ ਅੱਜ ਕੱਲ ਹੁਣ ਪੀਜ਼ਾ ਹੈ ਬਰਗਰ ਹੈ ਨੂਡਲਸ ਹੈ ਇਹ ਵੀ ਹਰ ਸ਼ਹਿਰ ਦੇ ਹਰ ਕੋਨੇ ਵਿੱਚ ਤੁਹਾਨੂੰ ਮਿਲਣਗੇ ਅਤੇ ਲੋਕ ਖਾਣਾ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਪਸੰਦ ਕਰਦੇ ਨੇ ਕਿੰਨੀਆਂ ਕਿੰਨੇ ਦੁਕਾਨਾਂ ਖੁੱਲ੍ਹ ਗਈਆਂ ਨੇ ਕਿੰਨੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਚੀਜ਼ਾਂ ਦੇ ਖੁੱਲ੍ਹ ਗਏ ਨੇ ਅਤੇ ਇਹ ਸਾਰੀਆਂ ਚੀਜ਼ਾਂ ਦਾ ਸਮੱਗਰੀਆਂ ਦਾ ਸੇਵਨ ਕਰਨਾ ਲੋਕ ਪਸੰਦ ਕਰਦੇ ਹੈ